ਪਾਣੀ ਸਾਡੀ ਜ਼ਿੰਦਗੀ ਲਈ ਬੜਾ ਅਹਿਮ ਹੈ ਇਸ ਲਈ ਸਾਨੂੰ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਪਾਣੀ ਦਿਨ ਰਾਤ ਵੱਧ ਤੋਂ ਵੱਧ ਪੀਣਾ ਚਾਹੀਦਾ ਹੈ ਵੱਧ ਪਾਣੀ ਪੀਣ ਨੂੰ ਚੰਗੀ ਸਿਹਤ ਦਾ ਰਾਜ਼ ਚਮਤਕੀ 'ਚ ਚਮਕ ਦੀ ਚਮੜੀ ਦਾ ਕਾਰਨ ਦੱਸਿਆ ਜਾਂਦਾ ਹੈ ਇਸ ਤੋਂ ਇਲਾਵਾ ਢੇਰ ਸਾਰਾ ਪਾਣੀ ਪੀ ਕੇ ਕੈਂਸਰ ਅਤੇ ਭਾਰ ਤੋਂ ਛੁਟਕਾਰਾ ਪਾਉਣ ਦੇ ਨੁਸਖੇ ਵੀ ਚਰਚਾ ਵਿੱਚ ਹਨ ਲੋਕ ਦੱਸਦੇ ਹਨ ਹਰ ਦਿਨ ਘੱਟੋ ਘੱਟ ਅੱਠ ਗਿਲਾਸ ਯਾਨੀ ਦੋ ਸੌ ਚਾਲੀ ਮਿਲੀਲੀਟਰ ਪਾਣੀ ਦੇ ਅੱਠ ਗਿਲਾਸ ਖਾਲੀ ਕਰਨੇ ਚਾਹੀਦੇ ਹਨ ਜਦੋਂ ਤੱਕ ਅਸੀਂ ਪਾਣੀ ਦੀ ਲੋੜ ਲੋੜੀਂਦਾ ਮਾਤਰਾ ਦੁਬਾਰਾ ਨਹੀਂ ਲੈ ਲੈਂਦੇ ਸਾਡੀ ਹਾਲਤ ਖਰਾਬ ਹੁੰਦੀ ਹੈ ਕਈ ਵਾਰ ਪਾਣੀ ਦੀ ਘਾਟ ਘਾਤਕ ਸਾਬਤ ਹੁੰਦੀ ਹੈ ਇਸ ਕਰਕੇ ਸਾਨੂੰ ਦਿਨ ਵਿੱਚ ਖੂਬ ਸਾਰਾ ਪਾਣੀ ਪੀਣਾ ਚਾਹੀਦਾ ਹੈ ਸਾਨੂੰ ਘੱਟੋ ਘੱਟ ਅੱਠ ਗਿਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਨਹੀਂ ਤਾਂ ਸਾਡੇ ਸਰੀਰ ਵਿੱਚ ਪਾਣੀ ਦੀ ਮਾਤਰਾ ਵੀ ਘਟ ਸਕਦੀ ਹੈ ਇਸ ਕਰਕੇ ਸਾਨੂੰ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਪਾਣੀ ਪੀਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਘਟਦੀਆਂ ਹਨ ਇਸ ਕਰਕੇ ਸਾਨੂੰ ਦਿਨ ਵਿੱਚ ਖੂਬ ਸਾਰਾ ਪਾਣੀ ਪੀਣਾ ਚਾਹੀਦਾ ਹੈ ਤਾਂ ਜੋ ਸਾਨੂੰ ਅੱਗੇ ਤੋਂ ਕੋਈ ਮੁਸ਼ਕਿਲ ਨਾ ਆਵੇ ਪਾਣੀ ਦੇ ਨਾਲ ਬਹੁਤ ਹੀ ਬਿਮਾਰੀਆਂ ਦੂਰ ਹੁੰਦੀਆਂ ਹਨ ਜੇ ਅਸੀਂ ਦਿਨ ਵਿੱਚ ਖੂਬ ਪਾਣੀ ਪੀਏ ਤਾਂ ਸਾਡੇ ਤਾਂ ਸਾਡੀ ਸਕਿੰਨ ਵੀ ਚਮਕਦੀ ਹੈ ਸਾਡੀ ਚਮੜੀ ਵੀ ਚਮਕਦੀ ਹੈ ਅਤੇ ਇਸ ਤੋਂ ਇਲਾਵਾ ਢੇਰ ਸਾਰਾ ਪਾਣੀ ਪੀ ਕੇ ਅਸੀਂ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਵੀ ਬਚ ਸਕਦੇ ਹਾਂ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਵੱਧ ਤੋਂ ਵੱਧ ਪਾਣੀ ਪੀਏ ਤਾਂ ਜੋ ਅਸੀਂ ਤੰਦਰੁਸਤ ਰਹੀਏ ਅਤੇ ਸੁਰਕਸ਼ਿਤ ਰਹੀਏ ਇਸ ਕਰਕੇ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ ਸਾਨੂੰ ਦਿਨ ਵਿੱਚ ਅੱਠ ਗਿਲਾਸ ਪਾਣੀ ਦੇ ਜ਼ਰੂਰ ਪੀਣਾ ਚਾਹੀਦਾ ਹੈ ਸਾਨੂੰ ਚਾਹੀਦਾ ਹੈ ਅਸੀਂ ਦਿਨ ਵਿੱਚ ਅੱਠ ਗਿਲਾਸ ਪਾਣੀ ਜ਼ਰੂਰ ਪੀਏ ਧੰਨਵਾਦ